ਹੈਲੋ ਹਾਂਜੀ ਵਧੀਆ ਜੀ ਤੁਸੀਂ ਦੱਸੋ ਥੈਂਕਯੂ ਹਾਂਜੀ ਹਾਂਜੀ ਹਾਂਜੀ ਜਰੂਰ ਮੈਂ ਤੁਹਾਨੂੰ ਪੁੱਛ ਰਿਹਾ ਸੀ ਤੁਹਾਡੇ ਮੁਕਤਸਰ ਦੇ ਸਭ ਤੋਂ ਵਧੀਆ ਸਕੂਲ ਕਿਹੜਾ

ਹਾਂਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਠੀਕ ਹ ਹਾਂਜੀ

ਹਾਂਜੀ ਹਾਂਜੀ ਠੀਕ ਆ ਚਲੋ ਫਿਰ ਹਾਂਜੀ ਹਾਂਜੀ

ਹਾਂਜੀ

ਚਲੋ ਹਾਂਜੀ ਚਲੋ ਫਿਰ ਮਿਲਦੇ ਆ ਹਾਂਜੀ ਜਰੂਰ ਠੀਕ